ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਗੱਲ ਕਰ ਰਹੇ ਹੋ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਸਰ ਅੱਛਾ ਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਕੋਈ ਗੱਲ ਨਹੀਂ ਸਰ ਕੋਈ ਗੱਲ ਨਹੀਂ ਹਾਂਜੀ ਹਾਂਜੀ ਵੈਸੇ ਤੁਸੀਂ ਆ ਕੇ ਇੱਕ ਵਾਰੀ ਆਪਣਾ ਤੁਹਾਨੂੰ ਅਸੀਂ ਸਲਿਪ 'ਤੇ ਵੀ ਲਿਖ ਕੇ ਦਵਾਂਗੇ ਸਾਰਾ ਕੁਛ ਪਰ ਫਿਰ ਵੀ ਮੈਂ ਤੁਹਾਨੂੰ ਇੱਕ ਵਰੀ ਫੋਨ 'ਤੇ ਵੀ ਸਾਰੀ ਚੀਜ਼ ਸਮਝਾ ਦਿੰਦੀ ਹਾਂ ਸਰ ਜਿਹੜੀ ਇਹ ਬੈਫਲੋ ਅਤੇ ਮੱਝਾਂ ਗਾਵਾਂ ਦੀ ਜਿਹੜੀ ਸਿਹਤ ਸੰਭਾਲ ਹੈਗੀ ਹੈ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਜਿਹੜੀਆਂ ਦੋ ਚੀਜ਼ਾਂ ਨੇ ਉਹ ਮੇਨ ਹੈਗੀਆਂ ਮੇਨ ਵਿਸ਼ਾ ਇਹ ਸੰਭਾਲ ਕਰਨ ਦਾ ਇੱਕ ਤਾਂ ਅਸੀਂ ਉਹਨਾਂ ਦੀ ਖਾਦ ਅਤੇ ਖੁਰਾਕ ਜਿਹੜੀ ਹੈਗੀ ਆ ਉਹ ਦਾ ਧਿਆਨ ਰੱਖਣਾ ਇੱਕ ਉਹਨਾਂ ਨੂੰ ਪਾਣੀ ਜਿਹੜਾ ਉਹ ਸਮੇਂ ਦੇ ਨਾਲ ਦਿੱਤਾ ਜਾਵੇ ਉਹਦਾ ਧਿਆਨ ਰੱਖਣਾ ਅਤੇ ਇੱਕ ਪਲੱਸ ਉਹਨਾਂ ਦੀ ਜਿਹੜੀ ਕੇਅਰ ਹੈਗੀ ਹੈ ਉਹ ਬਹੁਤ ਅ ਜਿਵੇਂ ਕਿ ਮੈਂ ਤੁਹਾਨੂੰ ਸਿਹਤ ਸੰਭਾਲ ਦੀ ਗੱਲ ਕੀਤੀ ਹੈ ਕਿ ਸਿਹਤ ਸੰਭਾਲ ਸਾਨੂੰ ਬਹੁਤ ਚੰਗੀ ਤਰੀਕੇ ਨਾਲ ਕਰਨੀ ਚਾਹੀਦੀ ਆ ਇਹਨਾਂ ਦੀ ਜਿਹੜਾ ਇਹਨਾਂ ਦਾ ਖਾਣ ਦਾ ਧਿਆਨ ਰੱਖਣ ਦੇ ਵਿੱਚ ਜਿਹੜੀਆਂ ਵਿਸ਼ੇਸ਼ ਚੀਜ਼ਾਂ ਹੈਗੀਆਂ ਨੇ ਉਹ ਉਹਦੇ ਵਿੱਚ ਇੱਕ ਤਾਂ ਇਹਨਾਂ ਦੇ ਜਿਹੜੇ ਨਿਊਟਰੈਂਟ ਨੇ ਉਹ ਇਹਨਾਂ ਦੀ ਸਰੀਰ ਵਾਸਤੇ ਬਹੁਤ ਜ਼ਰੂਰੀ ਨੇ ਜੋ ਜ ਜ਼ਰੂਰੀ ਮਾਤਰਾ ਦੇ ਵਿੱਚ ਇਹਨਾਂ ਨੂੰ ਦੇਣੇ ਚਾਹੀਦੇ ਨੇ ਉਹਦੇ ਵਿੱਚ ਇੱਕ ਪ੍ਰੋਟੀਨ ਆ ਜਾਂਦਾ ਕਰੂਡ ਪ੍ਰੋਟੀਨ ਅਸੀਂ ਉਹਨਾਂ ਨੂੰ ਬੋਲਦੇ ਹਾਂ ਉਹ ਤੁਸੀਂ ਇਹਨਾਂ ਨੂੰ ਦੇ ਸਕਦੇ ਹੋ ਇੱਕ ਇਹਦੇ ਵਿੱਚ ਰੂਮਨ ਪ੍ਰੋਟੈਕਟਡ ਫੈਟ ਹੁੰਦੀ ਹੈ ਜਿਹੜੀ ਇਹਨਾਂ ਦੀ ਐਨਰਜੀ ਲੈਵਲ ਨੂੰ ਅਤੇ ਮਿਲਕ ਦੀ ਕੁਆਲਿਟੀ ਨੂੰ ਅਤੇ ਜ਼ਿਆਦਾ ਮਾਤਰਾ ਵਿੱਚ ਜਿਹੜਾ ਦੁੱਧ ਹੈਗਾ ਉਹ ਪਸ਼ੂ ਦੇ ਸਕਦੇ ਨੇ ਉਹਦੇ ਵਿੱਚ ਇੱਕ ਇੱਕ ਆਪਾਂ ਚੂਰ ਚੀਜ਼ ਜਿਹੜੀ ਹੈਗੀ ਹੈ ਫੀਡ ਦੇ ਵਿੱਚ ਜਿਹੜੀ ਹੋਰ ਚੀਜ਼ ਇ ਐ ਐਡ ਕਰ ਸਕਦੇ ਹਾਂ ਉਹ ਅਸੀਂ ਬੋਲਦੇ ਹਾਂ ਉਹਨੂੰ ਕਲਸਟਰਮ ਕਰਕੇ ਇੱਕ ਨਾਮ ਦੀ ਚੀਜ਼ ਹੈ ਉਹ ਵੀ ਅਸੀਂ ਫੀਡ ਦੇ ਵਿੱਚ ਐਡ ਕਰ ਸਕਦੇ ਹਾਂ ਇਹਨਾਂ ਦੇ ਠੀਕ ਹੈ ਅਤੇ ਬਾਕੀ ਰਹੀ ਜੀ ਪਾਣੀ ਦੀ ਗੱਲ ਪਾਣੀ ਜਿਹੜਾ ਹੈਗਾ ਉਹ ਬਹੁਤ ਜ਼ਰੂਰੀ ਆ ਇਹਨਾਂ ਦੀ ਸਿਹਤ ਵਾਸਤੇ ਇਹਨਾਂ ਨੂੰ ਘੱਟੋ ਘੱਟ ਦਿਨ ਦੇ ਵਿੱਚ ਤਿੰਨ ਤੋਂ ਚਾਰ ਵਾਰੀ ਜਿੰਨੀ ਵੀਰ ਵੀ ਪਸ਼ੂ ਚਾਹੁੰਦਾ ਹੈ ਕਿ ਸਾਨੂੰ ਪਾਣੀ ਜਿਹੜਾ ਉਹ ਦਿੱਤਾ ਜਾਵੇ ਪੀਣ ਵਾਸਤੇ ਓਨੀ ਵਾਰ ਹੀ ਅਸੀਂ ਹਾਂਜੀ ਉਹ ਵੀ ਠੀਕ ਹੈ ਹਾਂਜੀ ਉਹ ਸਰ ਉਹਦੇ ਕਰਕੇ ਉਹਦਾ ਉਹਦਾ ਕਾਰਨ ਇਹ ਹੈ ਕਿ ਅੱਜ ਕੱਲ੍ਹ ਜਿਹੜੇ ਵਾਇਰਲ ਵਗੈਰਾ ਚੱਲਦੇ ਹੈਗੇ ਹੈ ਇਹਨ ਇਹ ਜਿਹੜੇ ਬਹੁਤ ਅ ਨੁਕਸਾਨਦਾਈ ਨੇ ਤਾਂ ਦੇਖੋ ਅ ਇਨਸਾਨਾਂ ਦੀ ਤਰ੍ਹਾਂ ਜਾਨਵਰਾਂ ਦੀ ਵੀ ਸਿਹਤ ਸੰਭਾਲ ਓਨੀ ਹੀ ਜ਼ਰੂਰੀ ਹੈ ਅਤੇ ਉਹਦੇ ਵਿੱਚ ਤੁਸੀਂ ਇੱਕ ਤਾਂ ਇਹਨਾਂ ਦੀ ਜਿਹੜੀ ਵੈਕਸੀਨੇਸ਼ਨ ਹੈਗੀ ਹੈ ਉਹ ਟਾਈਮ 'ਤੇ ਟਾਈਮ 'ਤੇ ਜ਼ਰੂਰ ਕਰਵਾਓ ਟਾਈਮ ਨਾਲ

ਇੰਜੈਕਸ਼ਨ ਹੈ ਉਹ ਲੱਗਦਾ ਹੈ ਅਤੇ ਅਸੀਂ ਉਹਨੂੰ ਲਗਵਾ ਕੇ ਤਾਂ ਕਿ ਜਿਹੜੇ ਪਸ਼ੂ ਨੇ ਉਹ ਜ਼ਿਆਦਾ ਬਿਮਾਰੀਆਂ ਦਾ ਸਾਹਮਣਾ ਨਾ ਕਰਨ ਠੀਕ ਹੈ ਜੀ ਅਤੇ ਦੂਸਰੀ ਹਾਂਜੀ ਇਹਨਾਂ ਚੀਜ਼ਾਂ ਦਾ ਤੁਸੀਂ ਧਿਆਨ ਰੱਖ ਕੇ ਇਹਨਾਂ ਦੀ ਸਿਹਤ ਵੀ ਅੱਛੀ ਹੋ ਜਾਵੇਗੀ ਅਤੇ ਜਿਹੜੀ ਮਿਲਕ ਪ੍ਰੋਡਕਟੀਵਿਟੀ ਉਹ ਵੀ ਤੁਹਾਡੀ ਵੱਧ ਜਾਵੇਗੀ

ਸਰ ਤੁਸੀਂ ਸਾਡੇ ਕੋਲ ਸਾਰਾ ਸਮਾਨ ਸਾਡੇ ਕੋਲ ਅਵੇਲੇਵਲ ਹੈ ਜੀ ਤੁਸੀਂ ਜਦੋਂ ਮਰਜੀ ਆ ਕੇ ਸਾਡੀ ਦੁਕਾਨ 'ਤੇ ਤੁਸੀਂ ਸਾਡੇ ਸ਼ੋਪ 'ਤੇ ਸਾਡੇ ਕਲੀਨਿਕ 'ਤੇ ਆ ਕੇ ਤੁਸੀਂ ਜਦੋਂ ਮਰਜੀ ਜਿਹੜੀਆਂ ਚੀਜ਼ਾਂ ਨੇ ਉਹ ਲੈ ਸਕਦੇ ਹੋ ਅਤੇ ਤੁਹਾਨੂੰ ਰੇਟ ਵੀ ਇੱਥੇ ਠੀਕ ਮਿਲੇਗਾ ਔਨਲਾਈਨ ਤੁਹਾਨੂੰ ਜਿਹੜਾ ਥੋੜ੍ਹਾ ਜਿਹਾ ਮਹਿੰਗਾ ਮਿਲਣ ਦੇ ਚਾਂਸਸ ਨੇ ਸਾਡੇ ਕੋਲ ਆਉਂਗੇ ਕੁਛ ਪਰਸਨ ਜਿਵੇਂ ਤੇ ਤੁਹਾਨੂੰ ਗੁਰਜੀਤ ਭਾਅ ਜੀ ਨੇ ਸਾਡੀ ਰਿਕਮੈਂਡੇਸ਼ਨ ਦਿੱਤੀ ਹੈ ਉਹਦੇ ਤਹਿਤ ਅਸੀਂ ਤੁਹਾਨੂੰ ਹੋਰ ਵੀ ਕੁਛ ਡਿਸਕਾਊਂਟ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਓਕੇ ਜੀ ਸਤਿ ਸ਼੍ਰੀ ਅਕਾਲ ਓਕੇ